ਰੂਪਨਗਰ ਜ਼ਿਲ੍ਹੇ ਵਿੱਚ ਆਵਾਜਾਈ ਦੇ ਮੁੱਖ ਵਿਲਕ ਵਿਕਲਪ ਸੜਕਾਂ ਅਤੇ ਰੇਲਵੇ ਹਨ ਉਰੇ ਦੀਆਂ ਸੜਕਾਂ ਜੋ ਕਿ ਕੈਲ ਉਹ ਕਿਹਾ ਜਾਵੇ ਕਿ ਸਾਨੂੰ ਬਹੁਤ ਹੀ ਅਲੱਗ ਅੱਲਗ ਜ਼ਿਲ੍ਹਿਆਂ ਨਾਲ ਜੋੜਦੀ ਹੈ ਜਿਵੇਂ ਕਿ ਸਾਡੇ ਟਿੱਬੀ ਸਾਹਿਬ ਗੁਰਦੁਆਰੇ ਵੱਲ ਤੋਂ ਸੜਕ ਜਾਂਦੀ ਹੈ ਨਵਾਂਸ਼ਹਿਰ ਨੂੰ ਠੀਕ ਹੈ ਔਰ ਜੇ ਅਸੀਂ ਦੂਜੀ ਸਾਈਡ ਨੂੰ ਉਹਤੇ ਉਲਟੀ ਸਾਈਡ ਨੂੰ ਜਾਈਏ ਤਾਂ ਉੱਧਰ ਨੂੰ ਸਾਨੂੰ ਚੰਡੀਗੜ੍ਹ ਪੈਂਦਾ ਔਰ ਸਾਡੇ ਰੋਪੜ ਦੇ ਵਿੱਚ ਰੇਲਵੇ ਸਟੇਸ਼ਨ ਵੀ ਹੈਗਾ ਜਿੱਥੇ ਕਿ ਰੇਲਵੇ ਸਟੇਸ਼ਨ ਦੇ ਕੋਲ ਕੋਈ ਵੀ ਫਾਟਕ ਦੇ ਕੋਲ ਜਿਹੜੇ ਵੀ ਫਾਟਕ ਉਨ੍ਹਾਂ ਕੋਲ ਕੋਈ ਵੀ ਫਲਾਈਓਵਰ ਜਾਂ ਫਿਰ ਅੰਡਰਗਰਾਊਂਡ ਆਉਣ ਜਾਣ ਦਾ ਰਾਹ ਨਹੀਂ ਹੈਗਾ ਜਿਹਦੇ ਨਾਲ ਕਿਆ ਹੁੰਦਾ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉੱਥੇ ਟਰੇਨ ਦੇ ਜਾਣ ਦੇ ਲਈ ਜਾਂ ਰੇਲ ਦੇ ਜਾਣ ਦੇ ਲਈ ਫਾਟਕ ਲੱਗਦੇ ਹੈ ਤਾਂ ਬਹੁਤ ਲੰਬਾ ਜਾਮ ਲੱਗ ਜਾਂਦਾ ਹੈ ਕਈ ਲੋਕ ਜਿਨ੍ਹਾਂ ਨੇ ਕੰਮਾਂ ਨੂੰ ਜਾਂ ਫਿਰ ਡਿਊਟੀਆਂ ਨੂੰ ਜਾਣਾ ਹੁੰਦਾ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਔਰ ਸਾਡਾ ਉਰੇ ਕੋ ਜੋ ਕਿ ਨਵਾਂ ਬੱਸ ਸਟੈਂਡ ਹੈ ਉਹਦੇ ਕੋਲ ਦਾ ਪੁਲ ਵੀ ਟੁੱਟਣ ਦੇ ਕਾਰਨ ਉਹਦੀ ਮੁਰੰਮਤ ਦੇ ਕੰਮ ਕਾਰਨ ਸਾਨੂੰ ਬਹੁਤ ਜ਼ਿਆਦਾ ਘੁੰਮ ਕੇ ਦੂਜੇ ਪਾਸੇ ਤੋਂ ਜਾਂ ਫਿਰ ਰੋਪੜ ਦੇ ਪੂਰੇ ਉੱਪਰ ਤੋਂ ਘੁੰਮ ਕੇ ਸਾਨੂੰ ਰੇਲਵੇ ਸਟੇਸ਼ਨ ਤੱਕ ਜਾਣਾ ਪੈਂਦਾ ਹੋਰ ਸਰਕਾਰ ਦੇ ਨਵੀ ਨੀਤੀਆਂ ਦੇ ਚੱਲਦਿਆਂ ਜਿਹੜਾ ਸਾਡਾ ਬੱਸ ਸਟੈਂਡ ਉਹ ਆਪਣੀ ਪੁਰਾਣੀ ਜਗ੍ਹਾ ਤੋਂ ਬਦਲ ਕੇ ਹੁਣ ਉਹ ਦੂਜੇ ਪਾਸੇ ਚੰਡੀਗੜ੍ਹ ਬਾਈਪਾਸ 'ਤੇ ਜਾ ਰਿਹਾ ਜਿੱਥੇ ਕਿ ਬਹੁਤ ਜ਼ਿਆਦਾ ਦੂਰ ਪੈ ਜਾਏਗਾ ਆਮ ਲੋਕਾਂ ਦੇ ਲਈ ਉਨ੍ਹਾਂ ਨੂੰ ਸਪੈਸ਼ਲ ਜਾਂ ਫਿਰ ਆਟੋ ਵਗੈਰਾ ਕਰਕੇ ਉੱਥੇ ਤੱਕ ਰਿਕਸ਼ਾ ਕਰਕੇ ਉੱਥੇ ਤੱਕ ਜਾਣਾ ਪਏਗਾ ਆਪਣੇ ਸਾਧਨਾਂ 'ਤੇ ਜਾਣਾ ਪਏਗਾ ਜੋ ਕਿ ਉਨ੍ਹਾਂ ਲਈ ਬਹੁਤ ਜ਼ਿਆਦਾ ਖਰੀਚੀਲਾ ਹੋ ਜਾਵੇਗਾ ਔਰ ਅੱਜ ਕੱਲ੍ਹ ਜ ਜਿਵੇਂ ਸਰਕਾਰ ਨੇ ਔਰਤਾਂ ਦਾ ਕਿਰਾਇਆ ਫ੍ਰੀ ਕਰ ਦਿੱਤਾ ਹੈ ਉੱਦਾਂ ਦੇ ਨਾਲ ਮਰਦਾਂ ਨੂੰ ਬਹੁਤ ਜ਼ਿਆਦਾ ਸਾਹਮ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅ ਜਿਵੇਂ ਕਿ ਪਰਾ ਜਿਹੜੀ ਸਰਕਾਰੀ ਬੱਸਾਂ ਉਹ ਹੈਗੀਆਂ ਉਹ ਔਰਤਾਂ ਨਾਲ ਹੈ ਭਰੀਆਂ ਰਹਿੰਦੀਆਂ ਹੈ ਅਤੇ ਮਰਦਾਂ ਨੂੰ ਉਨ੍ਹਾਂ ਦੇ ਵਿੱਚ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਤਾਂ ਇਸ ਕਰਕੇ ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਜਾਣਾ ਪੈਂਦਾ ਹੈ ਅਤੇ ਉਹ ਪ੍ਰਾਈਵੇਟ ਬੱਸਾਂ ਵਾਲੇ ਕਈ ਵਾਰ ਆਪਣੇ ਸਮੇਂ ਤੋਂ ਲੇਟ ਚੱਲਦੇ ਹਨ ਅਤੇ ਉਹ ਬਹੁਤ ਦੇਰੀ ਨਾਲ ਪਹੁੰਚਾਉਂਦੇ ਹਨ